ਟੈਕਨੋਲੋਜੀ ਨੇ ਬਥੇਰਿਆਂ ਲੋਕਾਂ ਦੀ ਮਦਦ ਕੀਤੀ ਹੈ ਬਟ ਸਭ ਤੋਂ ਵੱਧ ਜੇਕਰ ਇਸ ਦੀ ਜ਼ਰੂਰਤ ਨੂੰ ਪੂਰਾ ਕੀਤਾ ਹੈ ਤਾਂ ਉਹ ਬਿਰਧਾਂ ਅਤੇ ਦ੍ਰਿਸ਼ਟੀਹੀਣਾਂ ਦੀ ਬਿਰਧਾਂ ਅਤੇ ਦ੍ਰਿਸ਼ਟੀਹੀਣਾਂ ਲੋਕਾਂ ਦੀ ਟੈਕਨੋਲੋਜੀ ਨੇ ਬਹੁਤ ਵਧੀਆ ਤਰੀਕੇ ਨਾਲ ਮਦਦ ਕੀਤੀ ਹੈ ਇਸ ਦੇ ਸਭ ਤੋਂ ਵੱਡੀ ਉਦਾਹਰਣ ਹੈ ਬੀ ਮਾਈ ਆਈਸ ਕਰਕੇ ਇੱਕ ਐਪ ਇਸ ਐਪ ਵਿੱਚ ਜਿਹਨਾਂ ਨੂੰ ਦਿਖਾਈ ਨਹੀਂ ਦਿੰਦਾ ਅਤੇ ਜਿਹਨਾਂ ਦੀ ਨਜ਼ਰ ਕਮਜ਼ੋਰ ਹੈ ਉਹਨਾਂ ਲਈ ਇਹਨਾਂ ਵਾਸਤੇ ਬਹੁਤ ਵਧੀਆ ਸਹੂਲਤਾਂ ਦਿੱਤੀਆਂ ਗਈਆਂ ਹਨ ਇਸ ਵਿੱਚ ਤਕਰੀਬਨ ਇੱਕ ਸੌ ਅੱਸੀ ਭਾਸ਼ਾਵਾਂ ਦਾ ਦਿੱਤੀਆਂ ਗਈਆਂ ਹਨ ਜਿਸ ਵਿੱਚ ਲੋਕ ਆਪਣੀ ਆਪਣੀ ਭਾਸ਼ਾ ਨੂੰ ਚੂਜ ਕਰਕੇ ਉਹਨਾਂ ਰਾਹੀਂ ਗੱਲਾਂ ਕਰ ਸਕਦੇ ਹਨ ਇਸ ਵਿੱਚ ਦਸ ਕਰੋੜ ਤੋਂ ਵੱਧ ਲੋਕਾਂ ਨੇ ਹਿੱਸਾ ਲਿੱਤਾ ਹੈ ਜੋ ਕਿ ਬਿਰਧਾਂ ਅਤੇ ਦ੍ਰਿਸ਼ਟੀਹੀਣਾਂ ਦੀ ਮਦਦ ਕਰਦੇ ਹਨ ਅਸੀਂ ਦੇਖਿਆ ਹੈ ਕਿ ਇੱਥੇ ਲੋਕ ਜਿਹੜੇ ਆਉਂਦੇ ਹਨ ਉਹ ਹੁਣ ਦ੍ਰਿਸ਼ਟੀਹੀਣਾਂ ਲੋਕਾਂ ਦੀ ਬਹੁਤ ਵਧੀਆ ਤਰੀਕੇ ਨਾਲ ਮਦਦ ਕਰਦੇ ਹਨ ਉਹਨਾਂ ਨੂੰ ਜੋ ਜੋ ਵੀ ਚੀਜ਼ਾਂ ਦੀ ਜ਼ਰੂਰਤ ਹੈ ਉਹਨਾਂ ਨੂੰ ਉਹ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ ਉਹਨਾਂ ਨੂੰ ਕਿਸੇ ਵੀ ਚੀਜ਼ ਦੀ ਜ਼ਰੂਰਤ ਹੁੰਦੀ ਹਨ ਉਹ ਰੱਜ ਚੜ੍ਹ ਕੇ ਵੱਧ ਚੜ੍ਹ ਕੇ ਇਸ ਵਿੱਚ ਹਿੱਸਾ ਲੈਂਦੇ ਹਨ ਅਤੇ ਉਹਨਾਂ ਦੀ ਮਦਦ ਕਰਦੇ ਹਨ ਇਸ ਕਰਕੇ ਅਸੀਂ ਕਹਿ ਸਕਦੇ ਹਨ ਤਕ ਤਕਨੋਲੋਜੀ ਨੇ ਦ੍ਰਿਸ਼ਟੀਹੀਣਾਂ ਦੀ ਸਭ ਤੋਂ ਵੱਧ ਕੇ ਮਦਦ ਕੀਤੀ ਹੈ ਇਸ ਵਿੱਚ ਵੀਡੀਓ ਚਾਟ ਦੀ ਇੱਕ ਆਪਸ਼ਨ ਦਿੱਤੀ ਗਈ ਹੈ ਜਿਸ ਵਿੱਚ ਵੀਡੀਓ ਚੈਟ ਰਾਹੀਂ ਜਿਹਨਾਂ ਨੂੰ ਨਹੀਂ ਦਿਸਦਾ ਅਤੇ ਜੋ ਇਸ ਵਿੱਚ ਪਾਰਟ ਲੈ ਸਕਦੇ ਹਨ ਉਹਨਾਂ ਦੀ ਮਦਦ ਕਰਕੇ ਉਹਨਾਂ ਨੇ ਉਹਨਾਂ ਨੂੰ ਬਹੁਤ ਸਾਰੀ ਸਹੂਲਤਾਂ ਦਿੱਤੀਆਂ ਹਨ